ਹੈਲੋ ਹਾਂਜੀ ਕਾਰ ਡੀਲਰ ਬੋਲ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਗੱਡੀ ਪਰਚੇਜ਼ ਕਰਨ ਦੀ ਸਲਾਹ ਕਰ ਰਿਹਾ ਸਰ ਮੈਨੂੰ ਤਕਰੀਬਨ ਗੱਡੀ ਚਾਹੀਦੀ ਹੈ ਦਿੱਲੀ ਨੰਬਰ ਅਤੇ ਅੱਠ ਤੋਂ ਦਸ ਲੱਖ ਰੁਪਏ ਦੇ ਰੇਂਜ ਵਿੱਚ ਸਰ ਤੁਸੀਂ ਹਾਂਜੀ ਹਾਂਜੀ ਕਿਹੜੀ ਗੱਡੀ ਘੱਟ ਰੇਟ ਦੀ ਦਵਾ ਦਿਉ ਜੀ ਗੱਡੀ ਸਾਫ਼ ਹੋਣੀ ਚਾਹੀਦੀ ਹੈ ਸਰ ਕੰਪਨੀ ਟੋਯੋਟਾ ਮਿਲ ਜਾਵੇ ਟੋਯੋਟਾ ਮਿਲ ਜਾਵੇ ਫੋਰਡ ਮਿਲ ਜਾਵੇ ਹੁੰਡਈ ਮਿਲ ਜਾਵੇ ਹੁੰਡਈ 'ਚ ਤੁਹਾਡੇ ਕੋਲ ਕਿਹੜੀ ਅਵੈਲੇਬਲ ਹੈ ਜੀ ਕਰੇਟਾ ਖੜ੍ਹੀ ਹੈ ਕਰੇਟਾ ਵਰਨਾ ਠੀਕ ਹੈ ਜੀ ਕਿਹੜਾ ਮੌਡਲ ਹੈ ਜੀ ਤੇਰ੍ਹਾਂ ਮੌਡਲ ਕਿੰਨੇ ਕਿੰਨੇ ਕਿਲੋਮੀਟਰ ਚੱਲੀ ਹੋਈ ਹੈ ਜੀ ਠੀਕ ਹੈ ਜੀ ਡੀਜ਼ਲ ਹੈ ਕਿ ਪੈਟਰੋਲ ਹੈ ਡੀਜ਼ਲ ਹੈ ਕਿ ਪੈਟਰੋਲ ਹੈ ਜੀ ਅੱਛਾ ਇੱਕ ਮੈਨੂੂੰ ਇਹ ਦੱਸੋ ਜਿਹੜੀ ਆਰ ਸੀ ਵਗੈਰਾ ਤੁਸੀਂ ਚੇਂਜ ਕਰਵਾ ਕੇ ਦਿਉਂਗੇ ਮੇਰੇ ਨਾਂ 'ਤੇ ਜਿਵੇਂ ਦਿੱਲੀ ਨੰਬਰ ਆਪਾਂ ਨੇ ਲੈਣਾ ਅੱਛਾ ਉਹਦਾ ਕੋਈ ਖਰਚਾ ਫਿਰ ਐਕਸਟ੍ਰਾ ਲਉਂਗੇ ਤੁਸੀਂ ਅੱਛਾ ਜੀ ਉਹਦਾ ਕਿੰਨਾ ਖਰਚਾ ਆ ਜਾਂਦਾ ਅੱਛਾ ਜਿਵੇਂ ਹੁਣ ਦਿੱਲੀ ਦਿੱਲੀ ਨੰਬਰ ਆਪਾਂ ਗੱਡੀ ਖਰੀਦ ਦੇ ਹਾਂ ਤਾਂ ਉਹਦੀ ਜੇ ਆਪਾਂ ਪੰਜਾਬ ਦੇ ਵਿੱਚ ਚਲਾਈਏ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਡਾਕਯੂਮੈਂਟ ਦੀ ਜਾਂ ਕੋਈ ਅੱਛਾ ਜੀ ਨਹੀਂ ਕਈ ਵਾਰੀ ਇੱਦਾਂ ਕਹਿੰਦੇ ਹੁੰਦੇ ਵੀ ਕੋਈ ਪੁਲਿਸ ਵਾਲੇ ਜਾਂ ਹੋਰ ਕੋਈ ਦਿੱਕਤ ਤਾਂ ਨਹੀਂ ਆਵੇਗੀ ਅੱਛਾ ਠੀਕ ਹੈ ਜੀ ਅਤੇ ਜਿਹੜੀ ਗੱਡੀ ਚੱਲੀ ਹੋਈ ਹੈਗੀ ਤੁਹਾਡੇ ਕੋਲ ਵਰਨਾ ਇਹ ਕਿੰਨੇ ਕਿਲੋਮੀਟਰ ਚੱਲੀ ਹੋਈ ਜੀ ਅੱਛਾ ਸੱਤਰ ਸੱਤਰ ਕਿਲੋਮੀਟਰ ਨਹੀਂ ਕੁੱਲ ਸੱਤਰ ਕਿਲੋਮੀਟਰ ਅੱਛਾ ਠੀਕ ਹੈ ਜੀ ਕੋਈ ਸਕ੍ਰੈਚ ਵਗੈਰਾ ਕੁਛ ਹੋਰ ਅੱਛਾ ਜੀ ਅਤੇ ਫਿਰ ਚਲਾਈ ਕਿਉਂ ਨਹੀਂ ਹੈਗੀ ਜੀ ਇੰਨੇ ਸਾਲ ਹੋ ਗਏ ਅੱਛਾ ਦਿਲ ਨਹੀਂ ਕਰਿਆ ਚਲਾਉਣ ਨੂੰ ਚਲੋ ਫਿਰ ਮੈਂ ਤੁਹਾਡੇ ਕੋਲ ਕੱਲ੍ਹ ਨੂੰ ਦੇਖ ਕੇ ਜਾਵਾਂ ਜੀ ਆ ਕੇ ਠੀਕ ਹੈ ਜੀ